ਮੈਂ ਜ਼ਮੈਟੋ 'ਤੇ ਓਡਰ ਦਿੱਤਾ ਸੀਗਾ ਸਾਡਾ ਘਰ ਇੱਧਰ ਰੋਜ਼ ਗਾਰਡਨ ਦੇ ਕੋਲ ਸੀਗਾ ਅਤੇ ਉਹ ਮੈਂ ਸਨੈਕਰ 'ਤੇ ਔਨਲਾਈਨ ਓਡਰ ਕੀਤਾ ਸੀਗਾ ਲੇਕਿਨ ਕਿਸੇ ਵੀ ਡਿਲੀਵਰੀ ਬੋਆਏ ਨੇ ਉਹਨੂੰ ਪਿੱਕ ਨਹੀਂ ਕੀਤਾ ਤਾਂ ਅੱਧਾ ਘੰਟਾ ਪੌਣਾ ਘੰਟਾ ਮੈਂ ਵੇਟ ਕੀਤੀ ਉਸ ਬੰਦੇ ਦੀ ਤਾਂ ਉਹ ਹਜੇ ਤੱਕ ਮੇਰਾ ਓਡਰ ਨਹੀਂ ਲੈ ਕੇ ਆਇਆ ਮੈਂ ਉਹਨੂੰ ਬਹੁਤ ਮਿੰਨਤਾਂ ਵੀ ਕੀਤੀਆਂ ਬਾਈ ਜੀ ਤੁਸੀਂ ਓਡਰ ਕਿਉਂ ਨਹੀਂ ਚੱਕਿਆ ਪਿੱਕ ਕਿਉਂ ਨਹੀਂ ਕੀਤਾ ਤਾਂ ਉਦੋਂ ਸ਼ਾਇਦ ਮੈਨੂੰ ਲੱਗਦਾ ਕਿ ਟਾਈਮ ਜ਼ਿਆਦਾ ਹੋ ਗਿਆ ਸੀਗਾ ਤਾਂ ਕਰਕੇ ਉਨ੍ਹਾਂ ਨੇ ਓਡਰ ਨਹੀਂ ਚੱਕਿਆ ਅਤੇ ਉੱਥੇ ਮੇਰਾ ਓਡਰ ਬਣ ਵੀ ਗਿਆ ਸੀਗਾ ਅਤੇ ਬਣ ਬਣ ਕੇ ਉਸ ਤੋਂ ਬਾਅਦ ਉਹ ਮਤਲਬ ਪਿਆ ਰਿਹਾ ਉੱਥੇ ਅਤੇ ਉਸ ਤੋਂ ਬਾਅਦ ਉਹ ਖ਼ਰਾਬ ਹੋ ਗਿਆ ਓਡਰ ਤਾਂ ਜਦੋਂ ਡਲਿਵਰੀ ਬੋਆਏ ਪਹੁੰਚਿਆ ਤਾ ਤਦ ਓਡਰ ਮੇਰਾ ਬਿਲਕੁਲ ਹੀ ਖ਼ਰਾਬ ਹੋ ਗਿਆ ਸੀਗਾ ਜੀ ਤਾਂ ਉਸ ਕਰਕੇ ਫਿਰ ਮੈਨੂੰ ਓਡਰ ਕੈਂਸਲ ਕਰਨਾ ਪ ਪਊਗਾ ਅਤੇ ਤੁਹਾਡੇ ਰਿਫੰਡ ਪੋਲਸੀਜ਼ ਕੀ ਹੈ ਉਹ ਪਲੀਜ਼ ਮੈਨੂੰ ਦੱਸ ਸਕਦੇ ਹੋ ਮੇਰਾ ਇਹ ਹੀ ਨੰਬਰ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਸ਼ੁਕਰੀਆ ਕਰਾਂਗਾ ਉਮੀਦ ਕਰਾਂਗਾ ਕਿ ਤੁਸੀਂ ਮੇਰੇ ਜਿਹੜੇ ਪੈਸੇ ਹੈ ਰਿਫੰਡ ਕੀਤੇ ਕਰ ਦਿਓ